ਜਦੋਂ ਪੰਜਾਬ ਦੀਆਂ ਮਸ਼ਹੂਰ ਹਸਤੀਆਂ ਦੀ ਜਾਂ ਆਗੂਆਂ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਦੀ ਬਹੁਤ ਹੀ ਵੱਡੀ ਸ਼ਖਸੀਅਤ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਜਿਨ੍ਹਾਂ ਦਾ ਦਰਬਾਰ ਪੁਰਾਣੇ ਪੰਜਾਬ ਦੇ ਲਾਹੌਰ ਤੋਂ ਚੱਲਦਾ ਸੀ ਜਿਨ੍ਹਾਂ ਨੂੰ ਲਾਹੌਰ ਸੂਬਾ ਨਾਂ ਸੂਬੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਉਨ੍ਹਾਂ ਦੇ ਰਾਜ ਵਿੱਚ ਐਡੀ ਕੁ ਸ਼ਾਂਤੀ ਸੀ ਜੋ ਇਤਿਹਾਸਕਾਰ ਦੱਸਦੇ ਨੇ ਲਿਖਦੇ ਨੇ ਕਿ ਲੋਕ ਜੋ ਉੱਥੇ ਵਪਾਰ ਕਰਦੇ ਸੀ ਨਾ ਉਸ ਟਾਈਮ ਜਾਂ ਜੋ ਦੁ ਦੁਕਾਨਦਾਰ ਆਉਂਦੇ ਸੀਗੇ ਉਹ ਆਪਣੀ ਦੁਕਾਨ ਨੂੰ ਜਿੰਦਾ ਤੱਕ ਵੀ ਨਹੀਂ ਲਾ ਕੇ ਜਾਂਦੇ ਸੀਗੇ ਅਤੇ ਰਹੀ ਗੱਲ ਖੁਸ਼ਹਾਲੀ ਦੀ ਉਹ ਤਾਂ ਇੰਨੀ ਕੁ ਜ਼ਿਆਦਾ ਸੀ ਕਿ ਉਸ ਟਾਈਮ ਜੋ ਪੰਜਾਬ ਦੀ ਜੀ ਇਕੋਨਮੀ ਸੀਗੀ ਉਹ ਸਿਖਰਾਂ 'ਤੇ ਸੀ ਉਹਨਾਂ ਨੂੰ ਉਹਨਾਂ ਨੇ ਜੋ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਇਆ ਉਹਦਾ ਇਤਿਹਾਸ ਅੱਜ ਤੱਕ ਪੰਜਾਬ ਦੇ ਕਈ ਸ਼ਹਿਰਾਂ ਕਈ ਜ਼ਿਲ੍ਹਿਆਂ 'ਚੋਂ ਝਲਕਦੀ ਹੈ ਜੋ ਸਭ ਤੋਂ ਵੱਡੀ ਜਿਨ੍ਹਾਂ ਦੇ ਇੱਕ ਉਹਨਾਂ ਦੇ ਹੀ ਇੱਕ ਪੁੱਤਰ ਯਾਦਵਿੰਦਰ ਸਿੰਘ ਨੇ ਜਾਂ ਅੱਗੇ ਜਾ ਕੇ ਬਾਬਾ ਆਲਾ ਸਿੰਘ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਸ਼ਹਿਰ ਪਟਿਆਲਾ ਵਸਾਇਆ ਹੋਇਆ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਦੂਜੇ ਜੋ ਪੰਜਾਬੀ ਸਾਹਿਤਕਾਰ ਪੰਜਾਬੀ ਸਾਹਿਤ ਦੇ ਬਹੁਤ ਹੀ ਵੱਡੇ ਇਤਿਹਾਸਕਾਰ ਡਾਕਟਰ ਬੂਟਾ ਸਿੰਘ ਬਰਾੜ ਜਿਨ੍ਹਾਂ ਨੇ ਪੰਜਾਬੀ ਸਾਹਿਤ ਦਾ ਇਤਿਹਾਸ ਬੁੱਕ ਲਿਖੀ ਇਨ੍ਹਾਂ ਨੇ ਜੋ ਪੰਜਾਬੀ ਦੀ ਪੰਜਾਬੀ ਅਸ ਪੰਜਾਬ ਦਾ ਸਾਹਿਤ ਹੈ ਉਹਨਾਂ ਨੂੰ ਐਨਾ ਕੁ ਜ਼ਿਆਦਾ ਐਕਸਪਲੇਨ ਕੀਤਾ ਹੋਇਆ ਹੈਗਾ ਕਿ ਉਹ 'ਚੋਂ ਪੰਜਾਬ ਦੀ ਹਰ ਇੱਕ ਗੱਲ ਹਰ ਇੱਕ ਸ਼ਬਦ ਵੀ ਪੰਜਾਬੀ ਕਿੱਥੋਂ ਲਈ ਹੈ ਕਿੱਦਾਂ ਪੰਜਾਬੀ ਦਾ ਜਨਮ ਹੋਇਆ ਕਿੱਥੇ ਪਹੁੰਚੀ ਜੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੰਜਾਬੀ ਦਾ ਸਫਰ ਹੈ ਉਹ 'ਚ ਉਹ ਦਰਸਾਇਆ ਹੋਇਆ ਹੈਗਾ ਡਾਕਟਰ ਬੂਟਾ ਸਿੰਘ ਬਰਾੜ ਬਹੁਤ ਹੀ ਵੱਡੇ ਇਤਿਹਾਸਕਾਰ ਜਾਂ ਆਪਣੇ ਸਾਹਿਤਕਾਰ ਰਹਿ ਚੁੱਕੇ ਨੇ